ਫੋਟੋਗਰਾਫੀ ਸ਼ੁਰੂ ਕਰਨ ਲਈ ਮੈਨੂੰ ਯਾਦਾਂ ਨੇ ਪ੍ਰੇਰਿਤ ਕੀਤਾ ਕਿਉਂਕਿ ਫੋਟੋਗ੍ਰਾਫੀ ਦੇ ਨਾਲ ਤੁਸੀਂ ਆਪਣੀ ਪੁਰਾਣੀ ਤੋਂ ਪੁਰਾਣੀ ਯਾਦ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ 'ਤੇ ਤਾਜ਼ਾ ਕਰ ਸਕਦੇ ਹੋ ਫੋਟੋ ਇੱਕ ਟਾਈਮ ਮਸ਼ੀਨ ਦਾ ਕੰਮ ਕਰਦੀ ਹੈ ਜੋ ਤੁਹਾਨੂੰ ਬਹੁਤ ਸਾਲਾਂ ਪਿੱਛੇ ਲੈ ਜਾ ਸਕਦੀ ਹੈ ਅਤੇ ਤੁਹਾਨੂੰ ਬਹੁਤ ਹੀ ਆਨੰਦ ਦਵੇਗੀ ਤੁਸੀਂ ਆਪਣੇ ਅੱਛੇ ਅਤੇ ਸੁਹਾਣੇ ਪਲਾਂ ਨੂੰ ਦੁਬਾਰਾ ਯਾਦ ਕਰ ਸਕਦੇ ਹੋ ਇਸ ਦੇ ਲਈ ਮੈਨੂੰ ਬਾਹਰ ਘੁੰਮਦੇ ਫਿਰਦੇ ਲੋਕ ਘਰ ਦੇ ਵਿੱਚ ਕੁਝ ਹਸੀਨ ਪਲ ਆਪਣੀ ਫੋਟੋਗ੍ਰਾਫੀ ਦੇ ਵਿੱਚ ਇਕੱਠੇ ਕਰਨਾ ਬਹੁਤ ਪਸੰਦ ਹੈ ਇਸ ਲਈ ਮੈਂ ਫੋਟੋਗ੍ਰਾਫੀ ਬਹੁਤ ਪਸੰਦ ਕਰਦੀ ਹਾਂ ਮੈਂ ਇਸ ਵਿੱਚ ਆਪਣਾ ਬਹੁਤ ਸਮੇਂ ਬਿਤਾਂਦੀ ਹਾਂ